ਹੈਲੋ ਮੇਰੀ ਉਬਰ ਕੰਪਨੀ ਵਾਲਿਆਂ ਨਾਲ ਗੱਲ ਹੋ ਰਹੀ ਹੈ ਮੈਂ ਸੁਮੇਧਾ ਬੋਲ ਰਹੀ ਹੂੰ ਅਤੇ ਇਹ ਗਰਮੀਆਂ ਦੀਆਂ ਛੁੱਟੀਆਂ 'ਚ ਮੈਂ ਆਪਣੀ ਫੈਮਲੀ ਨਾਲ ਘੁੰਮਣਾ ਦਾ ਪਲੈਨ ਬਣਾ ਰਹੀ ਸੀ ਤਾਂ ਸਾਡਾ ਚੰਡੀਗੜ੍ਹ ਜਾਣ ਦਾ ਪਲੈਨ ਬਣ ਰਿਹਾ ਹੈ ਤਾਂ ਚੰਡੀਗੜ੍ਹ ਵਿੱਚ ਅਸੀਂ ਸੁਖਨਾ ਝੇਲ ਰੋਜ਼ ਗਾਡਨ 'ਤੇ ਘੁੰਮਣ ਜਾਣਾ ਹੈ ਅਤੇ ਉਸ ਤੋਂ ਇਲਾਵਾ ਮੈਂ ਬਾਈ ਸੈਕਟਰ ਵਿੱਚ ਵੀ ਜਾਣਾ ਸੀ ਮੈਨੂੰ ਅਤੇ ਮੇਰੇ ਘਰਵਾਲੇ ਨੂੰ ਕੁੱਝ ਕੰਮ ਸੀ ਅਤੇ ਜਾਣ ਜਾਂਦੇ ਦੇ ਵੇਲੇ ਅਸੀਂ ਘਰ ਦੇ ਪੰਜ ਮੈਂਬਰ ਹੋਉਂਗੇ ਮੈਂ ਮੇਰਾ ਹਸਬੈਂਡ ਮੇਰਾ ਇੱਕ ਬੱਚਾ ਅਤੇ ਮੇਰੇ ਸੱਸ ਅਤੇ ਸੋਹਰਾ ਅਤੇ ਜਾਂ ਤਾਂ ਜਾਣ ਦੇ ਲਈ ਤੁਸੀਂ ਸਵੇਰੇ ਪੰਜ ਵਜ਼ੇ ਤੱਕ ਆ ਜਿਓ ਅਸੀਂ ਸਾਢੇ ਪੰਜ ਵਜ਼ੇ ਤੱਕ ਨਿਕਲਣਾ ਹੈ ਤਾਂ ਤੁਸੀਂ ਥੋੜ੍ਹਾ ਪੰਜ ਵਜ਼ੇ ਤੱਕ ਸਾਡੇ ਘਰ ਦੇ ਕੋਲ ਆ ਜਿਓ ਅਤੇ ਸਾ ਅਤੇ ਮੇਰੇ ਘਰ ਦਾ ਪਤਾ ਹੈਗਾ ਹੈ ਰਾਮ ਗਲੀ ਰਾਮ ਗਲੀ ਅੱਠ ਨੰਬਰ ਗਲੀ ਹੈ ਰੋਪੜ ਵਿੱਚ ਹੀ ਹੈ ਖਾਸ ਰੋਪੜ ਵਿੱਚ ਅਤੇ ਉੱਥੇ ਆ ਜਿਓ